ਹੈਲੋ ਹਾਂਜੀ ਮੈਮ ਤੁਸੀਂ ਆ ਸਟਾਰ ਸਟੂਡੀਓ ਤੋਂ ਬੋਲਦੇ ਪਏ ਹੋ ਐਕਚੁਲੀ ਮੈਮ ਤੁਸੀਂ ਮੇਰੀ ਆ ਫ ਫਰੈਂਡ ਦਾ ਸ਼ੂਟ ਕੀਤਾ ਸੀਗਾ ਉਹਦੀ ਵੈਡਿੰਗ ਸੀਗੀ ਇੱਥੇ ਮੈਮ ਲਾਗੇ ਸੰਗਰੂਰ ਉਹਦੀ ਨਾ ਮੈਂ ਮੈਂ ਵੀ ਆ ਸ਼ੂਟ ਕਰਵਾਉਣਾ ਚਾਹੁੰਦੀ ਹਾਂ ਤੁਹਾਡੇ ਤੋਂ ਤਾਂ ਮੈਮ ਮੇਰਾ ਮੈਰਿਜ ਹੈ ਟਵੰਟੀ ਸੈਵਨ ਜਨਵਰੀ ਦੇਖ ਲਓ ਜੇ ਅਡਜਸਮੈਂਟ ਹੋ ਸਕਦੀ ਹੈ ਐਕਚੁਲੀ ਮੈਂ ਉਹਦੀ ਪਿੱਕਸ ਦੇਖੀਆ ਸੀਗੀਆਂ ਬਹੁਤ ਜ਼ਿਆਦਾ ਇਮੇਜ਼ਿੰਗ ਹਾਂਜੀ ਹਾਂਜੀ ਮਤਲਬ ਥੋੜ੍ਹਾ ਯੂਨੀਕ ਹੋਏ ਜਾਂ ਫਿਰ ਜਿੱਦਾਂ ਦਾ ਉਹਦਾ ਕੀਤਾ ਸੀਗਾ ਉਹ ਚਾਹੇ ਉਸ ਤੋਂ ਵੀ ਜ਼ਿਆਦਾ ਯੂਨੀਕ ਹੋਏ ਨਹੀਂ ਪਲੈਨ ਤਾਂ ਨਹੀਂ ਕੀਤਾ ਹੈਗਾ ਕਿ ਕਿੱਥੇ ਕਰਨਾ ਤੁਸੀਂ ਮੈਨੂੰ ਸੁਜਸਟ ਕਰ ਸਕਦੇ ਹੋ ਵੀ ਕਿੱਦਾਂ ਦਾ ਹੋਣਾ ਚਾਹੀਦਾ

ਹਾਂਜੀ ਹਾਂਜੀ ਓਕੇ ਮਤਲਬ ਉਹ ਬੈਸਟ ਤਾਂ ਰਹੂਗੀ ਨਾ ਓਕੇ ਮਤਲਬ ਚਾਹੀਦਾ ਤਾਂ ਮੈਨੂੰ ਪੰਜਾਬੀ ਕਲਚਰ ਦੇ ਵਿੱਚ ਹੀ ਆ ਜਿੱਦਾਂ ਮੇਰੀ ਫਰੈਂਡ ਦਾ ਕੀਤਾ ਸੀਗਾ ਉਦਾਂ ਦਾ ਹੀ ਮੁਜ ਥੋੜ੍ਹਾ ਥੋੜ੍ਹਾ ਉਦਾਂ ਦਾ ਹੋਵੇ ਹਾਂਜੀ ਓਕੇ ਅਤੇ ਮਤਲਬ ਥੋੜ੍ਹਾ ਜਿਹਾ ਨਾਈਟ ਦੇ ਨਾਈਟ ਦੇ ਸ਼ੂਟ ਵੀ ਕਰਨੇ ਸੀਗੇ ਤਾਂ ਉੱਥੇ ਨਾਈਟ ਦੇ ਵੀ ਪੋਸੀਬਲ ਹੋਣਗੇ ਓਕੇ ਅਤੇ ਮਤਲਬ ਮੈਨੂੰ ਆ ਕੋਸਟੀਊਮਸ ਕਿੱਦਾਂ ਦੇ ਇਹ ਚਾਹੀਦੇ ਹੋਣਗੇ ਓਕੇ ਓਕੇ ਠੀਕ ਹੈ ਮੈਂ ਇੱਕ ਵਾਰ ਹੁਣ ਤੁਸੀਂ ਮੈਨੂੰ ਆਪਣੀਆਂ ਸਨੈਪਸ ਵਗੈਰਾ ਭੇਜ ਦਿਓ ਅਤੇ ਮੈਂ ਤੁਹਾਨੂੰ ਦੱਸ ਦੱਸ ਦਵਾਂਗੀ ਕਿ ਕਿੱਦਾਂ ਦੀਆਂ ਚਾਹੀਦੀਆਂ ਹੋਣਗੀਆਂ ਹਾਂਜੀ ਏ ਸੀ 'ਤੇ ਕਰ ਦਿਓ ਓਕੇ ਥੈਂਕ ਯੂ ਓਕੇ